ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜਿਵੇਂ ਜਿੰਮੀ ਸ਼ੇਰਗਿੱਲ ਦੀ ਦਿਲਜੀਤ ਦੋਸਾਂਝ ਦੀ ਧਰਮਿੰਦਰ ਸੰਨੀ ਦਿਓਲ ਜੀ ਇਹ ਵੀ ਪੰਜਾਬ ਦੇ ਫਿਲਮਾਂ ਵਿੱਚ ਐਕਟਿੰਗ ਕਰਦੇ ਆ ਨਾਲੇ ਹਿੰਦੀ ਫਿਲਮਾਂ ਵਿੱਚ ਵੀ ਆਪਣਾ ਰੋਲ ਅਦਾਕਾਰ ਕਰਦੇ ਆ ਅਤੇ ਸਨੀ ਦਿਓਲ ਵੀ ਬੋਬੀ ਦਿਓਲ ਗਿੱਪੀ ਗਰੇਵਾਲ ਤਿੰਨੇ ਪੰਜਾਬੀ ਗਾਣੇ ਵਧੀਆ ਬੋਲਦੇ ਆ ਉਹ ਵੀ ਦੇਖੋ ਨਾਲੇ ਪੰਜਾਬੀ ਫਿਲਮਾਂ ਕਰਦੇ ਆ ਠੀਕ ਆ ਅਕਸ਼ੈ ਕੁਮਾਰ ਵੀ ਪੰਜਾਬੀ ਫਿਲਮਾਂ ਵੀ ਕਰਦੇ ਆ ਅਤੇ ਨਾਲ ਹੀ ਉਹ ਆਪਣਾ ਹਿੰਦੀ ਫਿਲਮਾਂ ਵੀ ਕਰਦੇ ਸੋਨੂੰ ਬਾਜਵਾ ਵੀ ਗੁਲਸ਼ਨ ਗਰੋਵਰ ਵੀ ਪ੍ਰੇਮ ਚੋਪੜਾ ਵੀ ਦਲੇਰ ਮਹਿੰਦੀ ਵੀ ਸੁਖਵਿੰਦਰ ਸਿੰਘ ਜੀ ਵੀ ਲਾਭ ਜੰਜੂਆ ਵੀ ਇਹ ਸਾਰੇ ਕਲਾਕਾਰ ਪੰਜਾਬ ਦੇ ਹੀ ਆ ਸਾਰੇ ਬਾ ਮਤਲਬ ਹਿੰਦੀ ਫਿਲਮਾਂ 'ਚ ਵੀ ਕੰਮ ਕਰਦੇ ਆ ਨਾਲ ਹਾਂਜੀ ਹਾਂਜੀ ਵੇਖੋ ਉਹ ਕਿੰਨਾ ਵਧੀਆ ਅ ਉਹ ਕਰ ਰਹੇ ਆ ਨਾਲ ਆਪਣਾ ਗਾਇਕੀ ਵੀ ਦਾ ਵੀ ਸ਼ੌਂਕ ਪੂਰਾ ਕਰ ਰਹੇ ਹਾਂ ਹਾਂਜੀ ਤਾਂ ਉਹ ਆਪਣਾ ਮਤਲਬ ਕਿ ਆਪਣਾ ਵੀ ਪੰਜਾਬ ਦਾ ਵੀ ਮਾਂ ਪਿਓ ਦਾ ਵੀ ਨਾਮ ਉਹ ਉੱਚਾ ਹੀ ਕਰ ਰਹੇ ਬਾਹਰ ਵੀ ਬਾਹਰਲੀਆਂ ਕੰ ਮਤਲਬ ਕਿ ਪੰਜਾਬ ਤੋਂ ਬਾਹਰ ਵੀ ਉਹ ਜਾ ਕੇ ਆਪਣਾ ਨਾਮ ਰੌਸ਼ਨ ਹੀ ਕਰ ਰਹੇ ਆਪਣੇ ਮਾਂ ਬਾਪ ਦਾ ਵੀ ਹਾਂਜੀ ਹਾਂਜੀ ਧਰਮਿੰਦਰ ਜਿੱਦਾਂ ਧਰਮਿੰਦਰ ਵੀ ਪੰਜਾਬ ਦੇ ਹਾਂ ਉਹਨਾਂ ਦੇ ਬੱਚੇ ਸੰਨੀ ਦਿਓਲ ਨੇ ਵੀ ਇਹ ਪੰਜਾਬੀ ਫਿਲਮਾਂ ਵੀ ਕੀਤੀਆਂ ਵਾ ਹਿੰਦੀ ਫਿਲਮਾਂ 'ਚ ਵੀ ਐਕਟਿੰਗ ਕੀਤੀ ਆ ਬੋਬੀ ਦਿਓਲ ਨੇ ਵੀ ਜਿੰਮੀ ਸ਼ੇਰਗਿੱਲ ਨੇ ਵੀ ਹਿੰਦੀ ਫਿਲਮਾਂ ਵੀ ਕੀਤੀਆਂ ਵਾ ਪੰਜਾਬੀ ਵੀ ਦਲੇਰ ਮਹਿੰਦੀ ਨੇ ਵੀ ਠੀਕ ਆ ਜੀ ਥੈਂਕ ਯੂ ਜੀ